ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਰ ਦੱਸੋ ਅੱਛਾ ਜੀ ਆਪਣਾ ਅੱਛਾ ਜੀ ਆਪਣੇ ਮੋਹਾਲੀ 'ਚ ਵਾਧੂ ਰੈਸਟੋਰੈਂਟ ਹੈ ਜੀ ਤੁਸੀਂ ਕਿਸ ਤਰ੍ਹਾਂ ਦਾ ਰੈਸਟਰੋਰੈਂਟ ਭਾਲਦੇ ਹੋ ਜੀ ਨੌਨ ਨੌਨ ਵੈਜ ਵੈਜ ਅੱਛਾ ਜੀ ਨੌਨ ਵੈਜ ਵੈਜ ਕੋਈ ਉਹ ਮਤਲਬ ਨੌਨ ਵੈਜ਼ ਚਾਹੀਦਾ ਰੈਸਟਰੋਰੈਂਟ ਜਾਂ ਵੈਜ ਚਾਹੀਦਾ ਜੀ ਜਿਸ ਤਰ੍ਹਾਂ ਕੀ ਸ਼ੁੱਧ ਵੈਸ਼ਨੂੰ ਹੁੰਦਾ ਜੀ ਰੈਸਟਰੋਰੈਂਟ ਇੱਕ ਨੌਨ ਵੈਜ ਹੁੰਦੇ ਕਿਹੜਾ ਰੈਸਟੋਰੈਂਟ ਤੁਸੀਂ ਅੱਛਿਆ ਵੈਜ ਚਾਹੀਦਾ ਜੀ ਆਪਣੇ ਕੋਲ ਬਹੁਤ ਰੈਸਟਰੋਰੈਂਟ ਹੈ ਜੀ ਮੋਹਾਲੀ 'ਚ ਹੁਣੀ ਮੈਂ ਤੁਹਾਨੂੰ ਦੱਸਦਾ ਜੀ ਆਪਣੇ ਕੋਲ ਇੱਕ ਹੈਗਾ ਹੈ ਜੀ ਫੂਡ ਟਾਊਨ ਹੈਗਾ ਹੈ ਜੀ ਉਹਦੇ 'ਚ ਹਰੇਕ ਤਰ੍ਹਾਂ ਦੀ ਵੈਰਾਈਟੀ ਮਿਲੂ ਤੁਹਾਨੂੰ ਵੈਜ ਚਾਪ ਵਗੈਰਾ ਜੀ ਚਾਪ ਪਾਸਤੇ ਨਿਊਡਲ ਬਾਕੀ ਤੁਹਾਨੂੰ ਪੰਜਾਬ ਦੇ ਮੱਕੀ ਦੇਸੀ ਘੀ ਯਾ ਆਪਣਾ ਦੇਸੀ ਘੀ ਆਲੀ ਰੋਟੀ ਸਾਗ ਮੱਕੀ ਦੀ ਰੋਟੀ ਬਾਕੀ ਹੋਰ ਸਾਰਾ ਸਬਜ਼ੀਆਂ ਸਪੈਸ਼ਲ ਥਾਲੀ ਸਭ ਕੁੱਝ ਅਤੇ ਇੱਕ ਹੈਗਾ ਆਪਣੇ ਕੋਲ ਆਪਣਾ ਇਹ ਵਿਰਦੀ ਵੈਸ਼ਨੂੰ ਢਾਬਾ ਹੈ ਜੀ ਉਹ ਉਹ ਉਹ ਬੜਾ ਫੇਮਸ ਹੈ ਜੀ ਉਹਨਾਂ ਦੀ ਦਾਲ ਮੱਖਣੀ ਬਹੁਤ ਬਹੁਤ ਫੇਮਸ ਹੈ ਜੀ ਇੱਕ ਹੈਗਾ ਆਪਣਾ ਭੈਣਾਂ ਦਾ ਢਾਬਾ ਉਹ ਉਹ ਵੀ ਬੜਾ ਫੇਮਸ ਹੈ ਜੀ ਆਪਣਾ ਆਪਣਾ ਥਰੀ ਬੀ ਟੂ ਹੈ ਛੇ ਫੇਸ ਹਾਂਜੀ ਹਾਂਜੀ ਹਾਂਜੀ ਹਾਂਜੀ ਇਹ ਬੈਸਟ ਦੱਸੇ ਹੈ ਜੀ ਹਾਂ ਹਾਂਜੀ ਠੀਕ ਹੈ ਜੀ ਓਕੇ